ਬਰਤਨ ਧੋਣ ਦੇ ਪ੍ਰਕਿਰਿਆ ਬਹੁਤ ਆਸਾਨ ਹੈ ਭਾਂਡੇ ਧੋਣਾ ਘਰ ਦੇ ਸਭ ਤੋਂ ਅਹਿਮ ਕਾਰਿਆਂ ਵਿੱਚੋਂ ਆਉਂਦਾ ਹੈ ਸਭ ਤੋਂ ਪਹਿਲੇ ਸਾਰੇ ਝੂਠੇ ਭਾਂਡੇ ਇਕੱਠੇ ਕਰੋ ਅਗਰ ਉਹਨਾਂ 'ਤੇ ਕੋਈ ਜੂਠਨ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਸਾਈਡ 'ਤੇ ਕੱਢ ਕੇ ਇੱਕ ਲਿਫਾਫੇ ਵਿੱਚ ਪਾ ਕੇ ਕੂੜੇਦਾਨ ਵਿੱਚ ਸਿੱਟ ਦਿਓ ਕੁੜੇਦਾਨ ਵਿੱਚ ਸਿੱਟਣ ਤੋਂ ਬਾਅਦ ਸਾਰੇ ਭਾਂਡੇ ਇਕੱਠੇ ਕਰ ਕੇ ਉਹਨਾਂ ਉੱਤੇ ਪਾਣੀ ਛਿੜਕੋ ਪਾਣੀ ਛਿੜਕਣ ਤੋਂ ਬਾਅਦ ਸਾਬਣ ਦਾਨੀ ਵਿੱਚੋਂ ਸਾਬਣ ਕੱਢ ਕੇ ਭਾਂਡਿਆਂ ਦੇ ਉੱਤੇ ਲਗਾਓ ਕੁਛ ਇੱਕ ਦੋ ਮਿੰਟ ਮਲਣ ਤੋਂ ਬਾਅਦ ਭਾਂਡਿਆਂ ਨੂੰ ਚੰਗੀ ਤਰ੍ਹਾਂ ਨਾਲ ਪਾਣੀ ਦੇ ਨਾਲ ਧੋਵੋ ਪਾਣੀ ਦੇ ਨਾਲ ਧੋਣ ਦੇ ਨਾਲ ਭਾਂਡੇ ਇੱਕਦਮ ਲਿਸ਼ਕ ਜਾਂਦੇ ਹਨ ਜੇਕਰ ਅਗਰ ਕੋਈ ਤੇਲ ਵਾਲਾ ਬਰਤਨ ਹੋਵੇ ਤਾਂ ਉਹਨੂੰ ਵੀ ਇਸ ਦੀ ਤਰ੍ਹਾਂ ਪਾਣੀ ਝਿੜਕਣ ਤੋਂ ਬਾਅਦ ਕੁਝ ਇੱਕ ਵਾਰੀ ਚੰਗੀ ਤਰ੍ਹਾਂ ਨਾਲ ਸਾਬਣ ਲਾਓ ਚੰਗੀ ਤਰ੍ਹਾਂ ਨਾਲ ਸਾਬਣ ਲਾਉਣ ਤੋਂ ਬਾਅਦ ਉਹਨੂੰ ਪਾਣੀ ਨਾਲ ਧੋ ਦਿਓ ਅਗਰ ਤੇਲ ਛੁੱਟ ਗਿਆ ਹੈ ਤਾਂ ਠੀਕ ਹੈ ਅਗਰ ਨਹੀਂ ਛੁੱਟਿਆ ਤਾ ਦੁਬਾਰਾ ਫਿਰ ਇੱਦਾਂ ਹੀ ਕਰੋ ਪਾਣੀ ਲਓ ਸਾਬਣ ਲਗਾਓ ਫਿਰ ਉਹਨੂੰ ਪਾਣੀ ਨਾਲ ਧੋ ਦਿਓ ਧੋਤੇ ਹੋਏ ਭਾਂਡਿਆਂ ਨੂੰ ਟੋਕਰੀ ਦੇ ਵਿੱਚ ਪਾ ਲਓ ਟੋਕਰੇ ਦੇ ਵਿੱਚ ਪਾਉਣ ਦੇ ਨਾਲ ਜਿੰਨਾ ਵੀ ਬਰਤਨਾਂ ਦੇ ਵਿੱਚ ਪਾਣੀ ਹੁੰਦਾ ਹੈ ਉਹ ਸਾਰਾ ਨਿਕਲ ਜਾਂਦਾ ਹੈ ਅਤੇ ਭਾਂਡੇ ਇੱਕਦਮ ਸੁੱਕ ਜਾਂਦੇ ਹਨ ਜਦੋਂ ਭਾਂਡੇ ਸਾਰੇ ਸੁੱਕ ਜਾਣਗੇ ਤਾਂ ਉਹਨਾਂ ਨੂੰ ਉਹਨਾਂ ਦੀ ਆਪਣੀ ਆਪਣੀ ਜਗ੍ਹਾ ਦੇ ਵਿੱਚ ਰੱਖ ਦਿਓ ਜਿਸ ਕਾਰਨ ਘਰ ਵਿੱਚ ਇੱਕਦਮ ਸਫ਼ਾਈ ਰਹਿੰਦੀ ਹੈ ਅਤੇ ਸਾਡੀ ਰਸੋਈ ਵੀ ਸਾਫ਼ ਰਹਿੰਦੀ ਹੈ